ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਇੰਸ਼ਟਾਗ੍ਰਾਮ ਪੇਜ ਤੋਂ ਪਿਛਲੇ ਹਫ਼ਤੇ ਇਲੈਕਟ੍ਰਿਕ ਬਲੈਂਕਿਟ ਮੰਗਵਾਇਆ ਸੀ ਜਿਸ ਦੀ ਪੈਕੇਜਿੰਗ ਬਹੁਤ ਹੀ ਵਧੀਆ ਸੀ ਅਤੇ ਇਹ ਸਮੇਂ ਸਿਰ ਮੇਰੇ ਤੱਕ ਪਹੁੰਚ ਗਿਆ ਅਤੇ ਤੁਹਾਡੇ ਡਿਲੀਵਰੀ ਬੋਏ ਦਾ ਸੁਭਾਅ ਵੀ ਬਹੁਤ ਹੀ ਜ਼ਿਆਦਾ ਚੰਗਾ ਸੀ ਇਹ ਬਲੈਂਕਿਟ ਮੇਰੇ ਪੂਰੇ ਬੈੱਡ 'ਤੇ ਫਿਟ ਆ ਗਿਆ ਅਤੇ ਇਹ ਬਹੁਤ ਹੀ ਘੱਟ ਬਿਜਲੀ ਲੈਂਦਾ ਹੈ ਇਸ ਕਰਕੇ ਮੈਂ ਬਹੁਤ ਹੀ ਖੁਸ਼ ਹਾਂ ਅਤੇ ਅੱਗੇ ਤੋਂ ਵੀ ਤੁਹਾਡੇ ਇੰਸ਼ਟਾਗ੍ਰਾਮ ਪੇਜ ਤੋਂ ਹੀ ਪ੍ਰੋਡਕਟ ਮੰਗਵਾਊਂਗਾ ਧੰਨਵਾਦ ਜੀ